ਘਰਾਂ ਦੇ ਵਿੱਚ ਬਗੀਚਿਆਂ ਦੀ ਸਾਂਭ ਸੰਭਾਲ ਕਰਨਾ ਸਸਤਾ ਜਾਂ ਮਹਿੰਗਾ ਪਰ ਸਵਾਲ ਇਹ ਹੈ ਕਿ ਇਹ ਜਿਹੜਾ ਸ਼ੌਕ ਹੈ ਘਰ ਦੇ ਵਿੱਚ ਖੂਬਸੂਰਤ ਬਗੀਚਾ ਬਣਾਉਣਾ ਜਾਂ ਹਰਿਆਲੀ ਪੈਦਾ ਕਰਨਾ ਜਾਂ ਚੰਗਾ ਵਾਤਾਵਰਨ ਪੈਦਾ ਕਰਨਾ ਇਹ ਇੱਕ ਸ਼ੌਕ ਦੀ ਗੱਲ ਹੈ ਇਹਦੇ ਵਿੱਚ ਮਹਿੰਗਾਈ ਸਸਤਾ ਜਾਂ ਮਹਿੰਗਾ ਨਹੀਂ ਦੇਖਿਆ ਜਾਂਦਾ ਹਰ ਆਦਮੀ ਚਾਹੁੰਦਾ ਹੈ ਕਿ ਮੇਰਾ ਸੋਹਣਾ ਘਰ ਹੋਵੇ ਉਹਦੇ ਵਿੱਚ ਫੁੱਲ ਬੂਟੇ ਲੱਗੇ ਹੋਣ ਉਹ ਹਰਿਆਲੀ ਹੋਏ ਬੱਚੇ ਖੇਡੇਦੇ ਹੋਣ ਜਾਂ ਆਪ ਬੈਠੀਏ ਉਹਦੇ ਵਿੱਚ ਇੱਕ ਸੁੰਦਰਤਾ ਦਾ ਸਰੋਤ ਹੈ ਘਰ ਦੇ ਵਿੱਚ ਬਗੀਚੇ ਨੂੰ ਤਿਆਰ ਕਰਨਾ ਜਾਂ ਮੈਨਟੈਨ ਕਰਨਾ ਇਹਦੇ ਵਿੱਚ ਕੁਝ ਸਮਾਂ ਲੱਗਦਾ ਹੈ ਤੁਸੀਂ ਅਗਰ ਜੇ ਚਾਹੋ ਤਾਂ ਸਵੇਰੇ ਕੁਝ ਸਮਾਂ ਦਸ ਵੀਹ ਮਿੰਟ ਜਾਂ ਦਸ ਵੀਹ ਮਿੰਟ ਸ਼ਾਮ ਨੂੰ ਰੋਜ਼ ਲਗਾਏ ਜਾਣ ਅਤੇ ਇਹਦੇ ਵਿੱਚ ਆਪਣਾ ਸਰੀਰ ਵੀ ਫਿਟ ਰਹਿੰਦਾ ਹੈ ਅਤੇ ਅਸੀਂ ਆਪਣੇ ਬਗੀਚੇ ਨੂੰ ਵੀ ਮੈਂਨਟੈਨ ਕਰ ਸਕਦੇ ਹਾਂ ਬਾਕੀ ਇੱਕ ਘਰ ਦੇ ਵਿੱਚ ਬਗੀਚਾ ਤਿਆਰ ਕਰਨ ਲਈ ਵੱਧ ਤੋਂ ਵੱਧ ਕੋਈ ਕੁਝ ਬੀਜ ਕੁਝ ਫੁੱਲ ਬੂਟੇ ਜਾਂ ਥੋੜ੍ਹੀ ਮੈਟੀਨੈਸ ਕੋਈ ਐਡੀ ਜ਼ਿਆਦਾ ਖਰਚੇ ਵਾਲੀ ਗੱਲ ਨਹੀਂ ਹੈ ਇਹਨੂੰ ਬੰਦਾ ਆਰਾਮ ਨਾਲ ਪਰਿਵਾਰਾਂ ਵਿੱਚ ਪਿੰਡ ਵਿੱਚ ਆਰਾਮ ਨਾਲ ਕਰ ਸਕਦਾ ਬਾਕੀ ਸ਼ਹਿਰਾਂ ਦਾ ਮੈਨੂੰ ਪਤਾ ਨਹੀਂ ਠੀਕ ਹੈ ਜੀ ਅਤੇ ਬਗੀਚੇ ਹੋਣੇ ਵੀ ਚਾਹੀਦੇ ਹਨ ਅਤੇ ਇਹ ਇਕ ਸ਼ੌਕ ਦੀ ਗੱਲ ਹੈ ਸ਼ੌਕ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਾਕੀ ਜੇ ਮਹਿੰਗੀ ਦੀ ਗੱਲ ਕਰੋ ਤਾਂ ਫਿਰ ਹਰ ਚੀਜ਼ ਮੁੱਲ ਲੈ ਕੇ ਫੁੱਲ ਬੂਟਾ ਲਾਉਣਾ ਤਾਂ ਉਹ ਤਾਂ ਬਹੁਤ ਮਹਿੰਗਾ ਵੀ ਪੈਂਦਾ ਅਤੇ ਇਹ ਵੀ ਘਰ ਦੀ ਸੁੰਦਰਤਾ ਨੂੰ ਬ ਬਹੁਤ ਵਧਾਉਂਦੇ ਹਨ ਇਸ ਕਰਕੇ ਘਰਾਂ ਦੇ ਵਿੱਚ ਸ਼ਹਿਰ ਹੋਣ ਜਾਂ ਪਿੰਡ ਫੁੱਲ ਬਗੀਚੇ ਜ਼ਰੂਰ ਲਾਉਣੇ ਚਾਹੀਦੇ ਆ ਠੀਕ ਹੈ ਜੀ ਅਤੇ ਠੀਕ ਹੈ ਬਾਕੀ ਸਰ ਚੰਗਾ ਜੀ